ਸਕੂਲਾਂ ਵਿੱਚ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ ਜਿਵੇਂ ਅੰਗਰੇਜ਼ੀ ਹਿਸਾਬ ਹਿੰਦੀ ਪੰਜਾਬੀ ਐਸ ਐਸ ਟੀ ਸਾਇੰਸ ਕੰਪਿਊਟਰ ਅਤੇ ਹਾਂਜੀ ਸਾਰੇ ਅਧਿਆਪਕ ਬੜੇ ਪੜ੍ਹੇ ਲਿਖੇ ਹਨ ਸੂਝਵਾਨ ਹਨ ਅਤੇ ਇਹ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ